ਹੈਲੋ ਹਾਂਜੀ ਗੁੱਡ ਆਫਟਰਨੂਨ ਹਾਂਜੀ ਮੈਂ ਹੁਸ਼ਿਆਰਪੁਰ ਤੋਂ ਨਿਤਿਸ਼ ਬੋਲ ਰਿਹਾ ਹੁਸ਼ਿਆਰਪੁਰ ਦੇ ਵਿੱਚ ਵੈਸੇ ਤਾਂ ਕਾਫੀ ਡਬਰਸ ਫੈਸਟੀਵਲ ਮਨਾਏ ਜਾਂਦੇ ਨੇ ਇੱਥੇ ਬਹੁਤ ਤਰ੍ਹਾਂ ਦੇ ਫੈਸਟੀਵਲ ਮਨਾਏ ਜਾਂਦੇ ਜਿੱਦਾਂ ਹੋਲੀ ਹੋ ਗਈ ਦਿਵਾਲੀ ਹੋ ਗਈ ਦੁਸਹਿਰਾ ਜਨਮਸ਼ਟਮੀ ਹੋ ਹੋ ਗਈ ਅਤੇ ਰੱਖੜੀ ਵੀ ਬਹੁਤ ਚਾਅ ਨਾਲ ਮਨਾਈ ਜਾਂਦੀ ਹੈ ਇੱਥੇ ਅਤੇ ਵਿਸਾਖੀ ਵਿਸਾਖੀ ਦੇ ਲਈ ਵੀ ਲੋਕ ਗੁਰਦੁਆਰਿਆਂ ਦੇ ਵਿੱਚ ਇੱਥੇ ਜਦੋਂ ਵੱਖ ਵੱਖ ਗੁਰੂਆਂ ਦੇ ਗੁਰਪੁਰਬ ਆਉਂਦੇ ਨੇ ਉਦੋਂ ਵੀ ਲੋਕ ਗੁਰਦੁਆਰੇ ਵਿਜਿ ਵਿਜਿਟ ਕਰਦੇ ਨੇ ਅਤੇ ਉਹਨਾਂ ਨੂੰ ਬਹੁਤ ਚਾਅ ਨਾਲ ਮਨਾਉਂਦੇ ਨੇ ਫੈਸਟੀਵਲ ਵਾਂਗੂ ਹੀ ਮਨਾਉਂਦੇ ਨੇ ਸ਼ੋਭਾ ਯਾਤਰਾ ਵੈਸੇ ਤਾਂ ਜਦੋਂ ਗੁਰਪੁਰਬ ਹੁੰਦੇ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਆਉਂਦਾ ਜਾਂ ਰਵਿਦਾਸ ਜੀ ਦਾ ਗੁਰਪੁਰਬ ਆਉਂਦਾ ਅਤੇ ਸ਼ਿਵਰਾਤਰੀ ਦੌਰਾਨ ਵੀ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਬਸਿਸ ਨੂੰ ਬਹੁਤ ਵਧੀਆ ਤਰ੍ਹਾਂ ਤਿਆਰ ਕੀਤਾ ਜਾਂਦਾ ਪੂਰੀ ਤਰ੍ਹਾਂ ਸਜਾਇਆ ਜਾਂਦਾ ਅਤੇ ਵਿੱਚ ਪਾਲਕੀ ਦੇ ਭਗਵਾਨ ਜੀ ਦੀ ਮੂਰਤੀ ਜਾਂ ਬੀੜ ਨੂੰ ਸਜਾਇਆ ਜਾਂਦਾ ਬਹੁਤ ਚੰਗੀ ਤਰ੍ਹਾਂ ਅਤੇ ਲੋਕ ਉੱਥੇ ਚੜ੍ਹਾਵਾ ਦਿੰਦੇ ਨੇ ਮੱਥਾ ਟੇਕਦੇ ਨੇ ਸਾਰਾ ਸ਼ਹਿਰ ਇਸ ਚੀਜ਼ ਨੂੰ ਬਹੁਤ ਚਾਅ ਨਾਲ ਦੇਖਦਾ ਉਤਸ਼ਾਹਿਤ ਹੁੰਦਾ ਇਸ ਚੀਜ਼ ਨੂੰ ਸਾਰਾ ਸਾਲ ਇੰਤਾ ਇੰਤਜ਼ਾਰ ਕਰਦੇ ਨੇ ਬਾਕੀ ਜੇ ਤੁਸੀਂ ਕੁਛ ਹੋਰ ਪੁੱਛਣਾ ਹੋਵੇ ਇਸ ਬਾਰੇ ਵੈਸੇ ਤਾਂ ਪੂਰਾ ਜਿੱਦਾਂ ਐਂਡਲੇ ਜਿਹੜੇ ਮੰਥ ਹੁੰਦੇ ਸਾਰੇ ਜਿਵੇਂ ਕਿ ਅਕਤੂਬਰ ਤੋਂ ਸ਼ੁਰੂ ਹੋ ਜਾਂਦੇ ਨੇ ਤਿਉਹਾਰ ਆਉਣੇ ਉਹ ਸਾਰੇ ਫਿਰ ਦਸੰਬਰ ਜਨਵਰੀ ਤੱਕ ਤਿਉਹਾਰ ਹੀ ਚੱਲਦੇ ਨੇ ਇਹ ਸਾਰੇ ਮੰਥ ਵਿੱਚ ਲੋਕ ਜ਼ਿਆਦਾਤਰ ਆਪਣੇ ਘਰਾਂ ਨੂੰ ਰੌਸ਼ਨ ਕਰਕੇ ਰੱਖਦੇ ਆ ਕਿਉਂਕਿ ਦਿਵਾਲੀ ਹੁੰਦੀ ਹੈ ਦੁਸਹਿਰਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆਉਂਦਾ ਅਤੇ ਨਵੇਂ ਸਾਲ ਕਰਕੇ ਵੀ ਲੋਕ ਬਹੁਤ ਖੁਸ਼ੀਆਂ ਮਨਾਉਂਦੇ ਨੇ ਦਿਵਾਲੀ ਖਾਸ ਕਰਕੇ ਲੋਕ ਬਹੁਤ ਚਾਅ ਨਾਲ ਮਨਾਉਂਦੇ ਇੱਥੇ ਲੋਕ ਪਟਾਕੇ ਚਲਾ ਕੇ ਜਾਂ ਆਪਣੇ ਘਰਾਂ ਦੇ ਉੱਤੇ ਲੜੀਆਂ ਲਾ ਕੇ ਘ ਘਰ ਨੂੰ ਰੌਸ਼ਨ ਕਰਦੇ ਆ ਅਤੇ ਰੌਸ਼ਨੀ ਫੈਲਾਉਂਦੇ ਆ ਚਾਰੋਂ ਪਾਸੇ ਦਿਵਾਲੀ ਦਿਵਾਲੀ ਤਾਂ ਹੈ ਹੀ ਬਹੁ ਬਹੁਤ ਲੋਕ ਐਕਸਾਈਟ ਹੋ ਮਨਾਉਂਦੇ ਨੇ ਇੱਕ ਹੋਰ ਜਿਵੇਂ ਦੁਸਹਿਰਾ ਆਉਂਦਾ ਦਿਵਾਲੀ ਤੋਂ ਵੀਹ ਦਿਨ ਪਹਿਲਾਂ ਦੁਸਹਿਰੇ ਦੌਰਾਨ ਵੀ ਲੋਕ ਮੇਲੇ ਇੱਥੇ ਮੇਲਾ ਲੱਗਦਾ ਬਹੁਤ ਮਸ਼ਹੂਰ ਦੁਸਹਿਰਾ ਗਰਾਊਂਡ ਉਹ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਨੇ ਕਿਉਂਕਿ ਪੂਰੇ ਪੰਜਾਬ ਵਿੱਚ ਹੁਸ਼ਿਆਰਪੁਰ ਦੁਸਹਿਰਾ ਬਹੁਤ ਮਸ਼ਹੂਰ ਆ ਅਤੇ ਇੱਥੇ ਹੁਸ਼ਿਆਰਪੁਰ ਦੇ ਨੌਜਵਾਨ ਵੀ ਜਿਹੜੇ ਝਾਕੀਆਂ ਕੱਢਦੇ ਨੇ ਹਨੂੰਮਾਨ ਜੀ ਦੀਆਂ ਹਨੂੰਮਾਨ ਜੀ ਦੇ ਵਾਂਗ ਬਣਾ ਕੇ ਅਤੇ ਉਹ ਸਾਰੇ ਸ਼ਹਿਰ ਦਾ ਫਿਰ ਤੋਰਾ ਲਾਉਂਦੇ ਨੇ ਲੋਕਾਂ ਦੇ ਘਰਾਂ ਵਿੱਚ ਜਾਂਦੇ ਨੇ ਅਤੇ ਲੋਕ ਉਹਨਾਂ ਨੂੰ ਪੂਜਦੇ ਆ ਆਰਤੀ ਕਰਦੇ ਆ ਅਤੇ ਚੜ੍ਹਾਵਾ ਵੀ ਦਿੰਦੇ ਹੈ ਪਲੂਸ਼ਨ ਤਾਂ ਵੈਸੇ ਦਿਵਾਲੀ ਦੌਰਾਨ ਹੀ ਹੁੰਦਾ ਹੈ ਜ਼ਿਆਦਾ ਕਿਉਂਕਿ ਲੋਕ ਪਟਾਕੇ ਬਹੁਤ ਯੂਜ ਕਰਦੇ ਨੇ ਪਟਾਕਿਆਂ ਦੇ ਵਿੱਚ ਕੈਮੀਕਲਜ਼ ਬਹੁਤ ਹੁੰਦੇ ਨੇ ਜਿਹੜੇ ਕਿ ਸਾਡੇ ਇਨਵਾਇਰਮੈਂਟ ਲਈ ਹਾਨੀਕਾਰਕ ਆ ਪਰ ਲੋਕ ਇਸ ਬਾਰੇ ਇੰਨੇ ਜ਼ਿਆਦਾ ਅਵੇਅਰ ਨਹੀਂ ਹੈਗੇ ਤਾਂ ਕਰਕੇ ਜ਼ਿਆਦਾਤਰ ਲੋਕ ਪਟਾਕੇ ਚਲਾਉਂਦੇ ਹੈ ਅਤੇ ਉਸ ਨਾਲ ਪਲੂਸ਼ਨ ਬਹੁਤ ਫੈਲਦਾ ਤਿਉਹਾਰ ਇੱਦਾਂ ਦਾ ਹੈ ਰੱਖੜੀ ਹੈ ਰੱਖੜੀ ਦੌਰਾਨ ਲੋਕ ਫੈਮਲੀ ਨਾਲ ਮਿਲਦੇ ਆਪਣੇ ਨਾਲ ਆਪਣੇ ਭਰਾ ਜਿਹੜੇ ਆਪਣੇ ਭੈਣਾਂ ਕੋਲ ਰੱਖੜੀ ਬੰਨ੍ਹਵਾਉਣ ਆਉਂਦੇ ਨੇ ਖੁਸ਼ੀਆਂ ਲਾਉਂਦੇ ਨੇ ਅਤੇ ਆਪਣੇ ਆਪ ਨੂੰ ਇੱਕ ਦੂਜੇ ਨੂੰ ਤੋਹਫੇ ਦਿੰਦੇ ਨੇ ਅਤੇ ਉਹ ਵੀ ਬਹੁਤ ਪਿਆਰ ਨਾਲ ਲੋਕ ਮਨਾਉਂਦੇ ਨੇ ਤਿਉਹਾਰ ਰੱਖੜੀ ਦਾ ਮੈਂ ਤਾਂ ਇਹੀ ਸੁਜੈਸ਼ਨ ਦੇਊਂਗਾ ਕਿ ਦੁਸਹਿਰਾ ਜਿਹੜਾ ਹੁਸ਼ਿਆਰਪੁਰ ਦਾ ਸਭ ਤੋਂ ਵਧੀਆ ਮਨਾਇਆ ਜਾਂਦਾ ਹੈ ਅਤੇ ਮੇਲਾ ਲੱਗਦਾ ਬਹੁਤ ਵਧੀਆ ਉਹ ਤੁਸੀਂ ਦੇਖਣ ਆਉ ਜ਼ਰੂਰ ਓਕੇ ਵੈਲਕਮ